ਹਾਂਜੀ ਮੈਂ ਆਪਣੇ ਬਚਪਨ ਤੋਂ ਹੀ ਇਤਿਹਾਸ ਨੂੰ ਸਿੱਖਣ ਦਾ ਆਨੰਦ ਮਾਣਿਆ ਹੈ ਔਰ ਮੇਰੇ ਪਾਪਾ ਜੀ ਮੈਨੂੰ ਸਾਡੇ ਇਤਿਹਾਸ ਦੀ ਕਹਾਣੀ ਵੀ ਸੁਣਾਉਂਦੇ ਹਨ ਮੇਰੇ ਪਾਪਾ ਨੇ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਵੀ ਕਹਾਣੀ ਸੁਣਾਈ ਸੀ ਉਹ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਉਦਾਸੀਆਂ ਕੀਤੀਆਂ ਔਰ ਕਿਸ ਤਰ੍ਹਾਂ ਉਹਨਾਂ ਨੇ ਇੱਕ ਉਦਾਸੀ ਕਰਦੇ ਟਾਈਮ ਇੱਕ ਮੰਦੇ ਜੇ ਬੰਦੇ ਦੇ ਘਰ ਵਿੱਚ ਜਾ ਕੇ ਉਸ ਦੀ ਸੁੱਕੀ ਰੋਟੀ ਖਾਧੀ ਕਿਸ ਤਰ੍ਹਾਂ ਇਹ ਦੱਸਿਆ ਗਿਆ ਕਿ ਜੋ ਕਿ ਉਹ ਮਤਲਬ ਕਿ ਮਾਸੂਮ ਆਦਮੀ ਸੀ ਉਸ ਦੀ ਇੱਕ ਵੱਡੇ ਆਦਮੀ ਦੇ ਘਰ ਵਿੱਚ ਖਾਣਾ ਖਾਣ ਨਹੀਂ ਗਿਆ ਤਾਂ ਉਸ ਨੇ ਕੋਈ ਵੀ ਉਹਨਾਂ ਨੂੰ ਕੋਈ ਚੀਜ਼ ਨਹੀਂ ਸੀ ਦਿੱਤੀ ਜਿਸ ਕਰਕੇ ਉਹਨੂੰ ਇੱਕ ਮਤਲਬ ਕਿ ਉਸ ਨੂੰ ਪਨਿਸ਼ ਕਰ ਕੀਤਾ ਜਾ ਰਿਹਾ ਸੀ ਉਸ ਦੇ ਤਰਫ਼ ਤੋਂ ਤਾਂ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆ ਕੇ ਉਸ ਨੂੰ ਕਿਹਾ ਕਿ ਤੇਰੀ ਜੋ ਵੀ ਇੱਥੇ ਖਾਣਾ ਭੋਜਨ ਦਾ ਆਮੰਤ੍ਰਨ ਸੀ ਉਹ ਕਿਸ ਤਰ੍ਹਾਂ ਤੂੰ ਲੋਕਾਂ ਦੇ ਖੂਨ ਪਸੀਨੇ ਨਾਲ ਕਮਾਈ ਹੋਈ ਰੋਟੀ ਤੋਂ ਦੇ ਰਿਹਾ ਸੀ ਔਰ ਕਿਸ ਤਰ੍ਹਾਂ ਉਸ ਬੰਦੇ ਨੇ ਮੈਨੂੰ ਆਪਣੀ ਮਿਹਨਤ ਦੀ ਕਮਾਈ ਦੀ ਰੋਟੀ ਦੇ ਕੇ ਮੈਨੂੰ ਸੰਤੁਸ਼ਟ ਕੀਤਾ ਹੈ ਤਾਂ ਉਸ ਅਮੀਰ ਆਦਮੀ ਨੇ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਕਿਵੇਂ ਮੇਰੀ ਰੋਟੀ ਖੂਨ ਪਸੀਨੇ ਦੀ ਕਮਾਈ ਨਾਲ ਅਵ ਬਣੀ ਹੋਈ ਹੈ ਅਤੇ ਕਿੱਦਾਂ ਉਸ ਦੀ ਬਹੁਤ ਹੀ ਜ਼ਿਆਦਾ ਮਿਹਨਤ ਦੀ ਰੋਟੀ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜਿਸ ਦੀ ਰੋਟੀ ਵਿੱਚ ਦੁੱਧ ਨਿਕਲੇਗਾ ਉਹ ਉਸ ਦੀ ਮਿਹਨਤ ਦੀ ਕਮਾਈ ਹੋਈ ਰੋਟੀ ਆ ਔਰ ਜਿਸ ਦੀ ਰੋਟੀ ਵਿੱਚ ਖੂਨ ਨਿਕਲੇਗਾ ਉਹ ਲੋਕਾਂ ਦੇ ਦੁਸ਼ਟ ਕਰਮਾਂ ਦੁਸ਼ਟੀ ਕਰਕੇ ਉਹਨਾਂ ਤੋਂ ਲਈ ਹੋਈ ਰੋਟੀ ਹੈ ਤਾਂ ਜਿਸ ਟਾਈਮ 'ਤੇ ਉਹਨਾਂ ਨੇ ਉਹਨਾਂ ਦੋਨਾਂ ਰੋਟੀਆਂ ਨੂੰ ਨਿਚੋੜਿਆ ਤਾਂ ਜੋ ਅਮੀਰ ਆਦਮੀ ਸੀ ਉਸ ਦੀ ਰੋਟੀ ਵਿੱਚੋਂ ਖੂਨ ਨਿਕਲਿਆ ਔਰ ਜੋ ਦੂਸਰਾ ਗਰੀਬ ਆਦਮੀ ਸੀ ਉਸ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ ਤਾਂ ਇਸ ਤੋਂ ਇਹ ਸਿੱਧ ਹੋਇਆ ਕਿ ਜੋ ਜਿਸ ਦੇ ਘਰ ਤੋਂ ਗੁਰੂ ਨਾਨਕ ਦੇਵ ਜੀ ਨੇ ਰੋਟੀ ਖਾਧੀ ਉਹ ਬਹੁਤ ਹੀ ਮਿਹਨਤੀ ਆਦਮੀ ਸੀ ਔਰ ਜੋ ਅਮੀਰ ਆਦਮੀ ਸੀ ਉਸ ਨੇ ਸਿਰਫ ਲੋਕਾਂ ਨੂੰ ਤਕਲੀਫ਼ ਦੇ ਕੇ ਉਹਨਾਂ ਤੋਂ ਰੋਟੀ ਖੋਹ ਕੇ ਲੰਗਰ ਲਗਾਇਆ ਹੋਇਆ ਸੀ ਔਰ ਇਸ ਕਹਾਣੀ ਤੋਂ ਮੈਨੂੰ ਇਹ ਪ੍ਰਭਾਵ ਪਿਆ ਸੀ ਕਿ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਮਿਹਨਤ ਦੀ ਕਮਾਈ ਖਾਓ ਔਰ ਜੋ ਵੀ ਆਪਣੇ ਜ਼ਿੰਦਗੀ ਵਿੱਚ ਕਰੋ ਆਪਣੀ ਮਿਹਨਤ ਦਾ ਹੀ ਕਰੋ ਕਿਸੇ ਦੂਸਰੇ ਨੂੰ ਕਸ਼ਟ ਪਹੁੰਚਾ ਕੇ ਅਸੀਂ ਸੁੱਖ ਨਹੀਂ ਪਾ ਸਕਦੇ ਧੰਨਵਾਦ